ਫ਼ਿਲਮੀ ਕਲਾਕਾਰ ਬਹੁਤ ਸਾਰੇ ਸਿਤਾਰੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਕਮੇਡੀ ਕਿੰਗ ਜਿਹੜੇ ਹੈ ਉਹ ਇੱਕ ਤਾਂ ਸਾਡੇ ਜਿਹੜੇ ਪੰਜਾਬ ਦੇ ਮੌਜੂਦਾ ਸੀ ਐੱਮ ਹੈ ਮੁੱਖ ਮੰਤਰੀ ਉਹ ਵੀ ਕਮੇਡੀ ਕਲਾਕਾਰ ਹੈ ਫ਼ਿਲਮੀ ਕਲਾਕਾਰ ਰਹੇ ਆ ਅਤੇ ਉਹਨਾਂ ਤੋਂ ਇਲਾਵਾ ਜਸਵਿੰਦਰ ਭੱਲਾ ਜੀ ਹੈ ਉਹਨਾਂ ਦੇ ਨਾਲ਼ ਅਨਮੋਲ ਹੈ ਇਹ ਬਹੁਤ ਸਾਰੇ ਫ਼ਿਲਮੀ ਸਿਤਾਰੇ ਹੈਗੇ ਜਿਨ੍ਹਾਂ ਨੂੰ ਅਸੀਂ ਮਿਲ ਕੇ ਉਹਨਾਂ ਦੇ ਜੀਵਨ ਬਾਰੇ ਪੁੱਛਾਂਗੇ ਅਤੇ ਕਿਵੇਂ ਉਹ ਕਮੇਡੀ ਕਰਦੇ ਆ ਕਿ ਅਸੀਂ ਇਹ ਵੀ ਪੁੱਛਾਂਗੇ ਉਹਨਾਂ ਕੋਲੋਂ ਵੀ ਤੁਸੀਂ ਕਮੇਡੀ ਕਰਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਸੱਚ ਮੁੱਚ ਇਹੋ ਜਿਹਾ ਜੋ ਕਮੇਡੀ ਕਰਦੇ ਹੋ ਕਦੇ ਘਟਿਆ ਹੈ ਇਸ ਤਰ੍ਹਾਂ ਦੇ ਸਵਾਲ ਪੁੱਛਾਂਗੇ